ਭਾਰਤ ਵਿੱਚ ਸਿਹਤ ਸੰਭਾਲ ਅ ਪ੍ਰਣਾਲੀ ਜਿਹੜੀ ਇੰਨੀ ਇਫੈਕਟਿਵ ਨਹੀਂ ਹੈਗੀ ਜਿਵੇਂ ਅਸੀਂ ਬਾਹਰਲੇ ਦੇਸ਼ਾਂ ਦੀ ਸੁਣਦੇ ਹਾਂ ਪਹਿਲੀ ਗੱਲ ਤਾਂ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਸੁਣਿਆ ਕਿ ਉੱਥੇ ਤਾਂ ਫ਼ਰੀ ਹੈ ਮੈਡੀਕਲ ਸਾਰਾ ਫ਼ਰੀ ਹੁੰਦਾ ਉਹਨਾਂ ਦੇ ਜੋ ਹੈਗੇ ਆ ਉਹਨਾਂ ਦੇ ਬ ਬਛਿੰਦੇ ਹੈਗੇ ਆ ਭਾਰਤ ਵਿੱਚ ਮਹਿੰਗਾ ਵੀ ਹੈ ਇਹ ਅਤੇ ਦੂਜੀ ਗੱਲ ਹੈ ਕਿ ਜੇ ਅਸੀਂ ਆਪਾਂ ਸਰਕਾਰੀ ਹੋਸਪੀਟਲਾਂ ਦਾ ਜਾਂ ਕਲੀਨਿਕਾਂ ਦਾ ਹਾਲ ਦੇਖੀਏ ਤਾਂ ਜਾਣ ਨੂੰ ਦਿਲ ਹੀ ਨਹੀਂ ਕਰਦਾ ਉੱਥੇ ਕਿਉਂਕਿ ਨਾ ਤਾਂ ਉੱਥੇ ਸਫਾਈ ਨਾਮ ਦੀ ਕੋਈ ਚੀਜ਼ ਹੁੰਦੀ ਹੈ ਪਹਿਲੀ ਗੱਲ ਡੋਕਟਰ ਹੀ ਟਾਈਮ ਸਿਰ ਨਹੀਂ ਮਿਲਦੇ ਕਦੇ ਤੁਹਾਨੂੰ ਮਿਲਣਗੇ ਹੀ ਨਹੀਂ ਜਾਂ ਡੋਕਟਰਾਂ ਦੀ ਅਪੋਇੰਟਮੈਂਟ ਹੀ ਨਹੀਂ ਹੁੰਦੀ ਗੌਰਮਿੰਟ ਵੱਲੋਂ ਵੀ ਡੋਕਟਰ ਹੀ ਵੀ ਅਵੇਲੇਵਲ ਨਹੀਂ ਹੁੰਦੇ ਹੈਗੇ ਕਨਸਰਨ ਡੋਕਟਰ ਜਿਹੜੇ ਹੋਣ ਬਿਮਾਰੀ ਨਾਲ਼ ਅਤੇ ਜੇ ਮਤਲਬ ਚਲੇ ਜਾਓ ਤਾਂ ਲੰਬੀਆਂ ਲੰਬੀਆਂ ਲਾਈਨਾਂ 'ਚ ਖੜ੍ਹੋ ਤਾਂ ਉਹ ਬਣਾਓ ਪਹਿਲਾਂ ਪਰਚੀਆਂ ਬਣਵਾਓ ਉਹ ਹੀ ਨਹੀਂ ਬਣਾਉਣ 'ਚ ਆਉਂਦੇ ਪਰਚੀਆਂ ਵਗੈਰਾ ਸਹੀ ਢੰਗ ਨਾਲ਼ ਹੈ ਨਾ ਅਤੇ ਦੂਜੀ ਗੱਲ ਆ ਕਿ ਫਿਰ ਡੋਕਟਰ ਬੜੀ ਦੂਜੀ ਨਾਲ਼ ਚੈੱਕ ਬੜੀ ਬੇਮਨੀ ਜਿਹੀ ਨਾਲ਼ ਚੈੱਕ ਕਰਦੇ ਆ ਜਿਵੇਂ ਹੈ ਨਾ ਅਤੇ ਜੇ ਚੈੱਕ ਕਰ ਲੈਣਗੇ ਅਤੇ ਤਾਂ ਫਿਰ ਤੁਹਾਨੂੰ ਜਿਹੜੀਆਂ ਹੋਣੀਆਂ ਚਾਹੀਦੀਆਂ ਮੈਡੀਕਲ ਦਵਾਈਆਂ ਉੱਥੇ ਫ਼ਰੀ ਹੋਣੀ ਚਾਹੀਦੀ ਹੋਸਪੀਟਲ 'ਚ ਉਹ ਕਦੇ ਮਿਲਦੀਆਂ ਹੀ ਨਹੀਂ ਹੈ ਹਮੇਸ਼ਾਂ ਡਾਕਟਰ ਤੁਹਾਨੂੰ ਲਿਖ ਕੇ ਦੇਣਗੇ ਤੁਹਾਨੂੰ ਬਾਹਰੋਂ ਲੈਣੀਆਂ ਪੈਣਗੀਆਂ ਮੈਡੀਕਲ ਹਾਲ ਤੋਂ ਜਾ ਕੇ ਖਰੀਦਣ ਤੋਂ ਉਹ ਮਹਿੰਗਾ ਹੀ ਪੈਂਦਾ ਆ ਕੰਮ ਸੋ ਇਹ ਸਾਰੀਆਂ ਚੀਜ਼ਾਂ ਨੂੰ ਸੁਧਾਰਿਆ ਜਾਣਾ ਚਾਹੀਦਾ ਆ ਪਹਿਲੀ ਗੱਲ ਤਾਂ ਕਿ ਘੱਟੋ ਘੱਟ ਮੈਡੀਕਲ ਜਿਹੜਾ ਟੋਟਲੀ ਫ਼ਰੀ ਹੋਣਾ ਚਾਹੀਦਾ ਇੰਡੀਅਨਸ ਨੂੰ ਸਾਰੇ ਭਾਰਤੀਆਂ ਦੇ ਲਈ ਹੈ ਨਾ ਦਵਾਈਆਂ ਉੱਥੋ ਅੰਦਰੋਂ ਹੀ ਮਿਲਨੀਆਂ ਚਾਹੀਦੀਆਂ ਆ ਸਾਫ਼ ਸਫਾਈ ਦਾ ਉੱਥੇ ਮਤਲਬ ਹੋਸਪੀਟਲਾਂ 'ਚ ਖਾਸ ਧਿਆਨ ਹੋਣਾ ਚਾਹੀਦਾ ਆ ਕਿਉਂਕਿ ਆਪਾਂ ਆਮ ਗ ਗੱਲ ਕਰਦੇ ਕਿ ਘਰਾਂ 'ਚ ਸਾਫ਼ ਸਫਾਈ ਨਹੀਂ ਤਾਂ ਹੀ ਬਿਮਾਰੀਆਂ ਫ਼ੈਲਦੀਆਂ ਪਰ ਜੇ ਹੋਸਪੀਟਲਾਂ 'ਚ ਸਫਾਈ ਨਹੀਂ ਤਾਂ ਹੋਰ ਵੀ ਜ਼ਿਆਦਾ ਬਿਮਾਰੀਆਂ ਫੈਲਣ ਦਾ ਖ਼ਤਰਾ ਏ ਕਿਉਂਕਿ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਪੇਸ਼ੈਂਟ ਆ ਜਾਂ ਕਿਸ ਤਰ੍ਹਾਂ ਦੇ ਪੇਸ਼ੈਂਟ ਹੈਗੇ ਆ ਸੋ ਉੱਥੇ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਹੋਣਾ ਚਾਹੀਦਾ ਆ ਬਾਕੀ ਡੋਕਟਰਸ ਨੂੰ ਚਾਹੀਦਾ ਏ ਕਿ ਮਤਲਬ ਡੋਕਟਰਸ ਦੀ ਅਪੋਇੰਟਮੈਂਟ ਹੋਣੀ ਚਾਹੀਦੀ ਹੈ ਸਰਕਾਰ ਵੱਲ੍ਹੋਂ ਪਰੋਪਰ ਸਾਰੇ ਡੋਕਟਰ ਉੱਥੇ ਹੋਣੇ ਚਾਹੀਦੇ ਆ ਧੰਨਵਾਦ